ਉੱਤਰੀ ਪੰਜਾਬ ਨੂੰ ਜੰਮੂ ਕਸ਼ਮੀਰ ਦਾ ਬਾਡਰ ਪੈਂਦਾ ਹੈ ਅਤੇ ਉੱਤਰੀ ਪੰਜਾਬ ਵਿੱਚ ਮਾਝਾ ਖੇਤਰ ਪੈਂਦਾ ਹੈ ਇਸ ਨੂੰ ਬਾਡਰ ਵਿੱਚ ਪਾਕਿਸਤਾਨ ਦਾ ਬਾਡਰ ਪੈਂਦਾ ਹੈ ਉੱਤਰੀ ਪੰਜਾਬ ਨੂੰ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਸ਼ਹਿਰ ਆਉਂਦੇ ਹਨ ਅਤੇ ਪੱਛਮੀ ਪੰਜਾਬ ਦਾ ਮੌਸਮ ਸਰਦੀਆਂ ਵਿੱਚ ਠੰਡਾ ਅਤੇ ਗਰਮੀਆਂ ਵਿੱਚ ਗਰਮ ਹੁੰਦਾ ਹੈ ਸਾਉਣ ਮਹੀਨੇ ਬਰਸਾਤਾਂ ਪੈਂਦੀਆਂ ਅਤੇ ਪੱਤਝੜ ਦੀ ਰੁੱਤ ਵੀ ਆਉਂਦੀ ਹੈ ਅਤੇ ਪੂਰੇ ਪੰਜਾਬ ਵਿੱਚ ਬਸੰਤ ਰੁੱਤ ਵੀ ਆਉਂਦੀ ਹੈ ਜਿਸ ਰੁੱਤ ਵਿੱਚ ਲੋਕ ਮਿੱਠੇ ਚੌਲ ਬਣਾਉਂਦੇ ਹਨ ਸਰੋਂ ਦੇ ਬੂਟਿਆਂ ਨੂੰ ਪੀਲੇ ਫੁੱਲ ਵੀ ਖਿੜਨ ਲੱਗ ਜਾਂਦੇ ਹਨ ਅਤੇ ਬਰਸਾਤ ਵਿੱਚ ਲੋਕ ਮਾਲ ਪੂੜੇ ਬਣਾ ਕੇ ਖਾਂਦੇ ਹਨ ਮਾਰਚ ਮਹੀਨੇ ਵਿੱਚ ਲੋਕ ਕੌੜੀਆਂ ਚੀਜ਼ਾਂ ਦਾ ਬਹੁਤ ਸੇਵਨ ਕਰਦੇ ਹਨ ਜਿਵੇਂ ਕਿ ਚਾਸਕੂ ਜੋ ਸਰੀਰ ਦੀਆਂ ਬਹੁਤ ਬਿਮਾਰੀਆਂ ਠੀਕ ਕਰਦਾ ਹੈ